ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਕਬੱਡੀ ਖੇਡ ਬਹੁਤ ਹੀ ਜ਼ਿਆਦਾ ਮੁਸ਼ਕਲ ਲੱਗਦੀ ਹੈ ਖੇਡਣੀ ਪਰ ਫਿਰ ਵੀ ਮੈਂ ਇਸਨੂੰ ਖੇਡਦੀ ਹਾਂ ਅਤੇ ਬੱਟ ਇਹ ਖੇਡਣੀ ਮੈਨੂੰ ਬਹੁਤ ਹੀ ਜ਼ਿਆਦਾ ਮੁਸ਼ਕਲ ਲੱਗਦੀ ਆ ਅਤੇ ਇਸ ਵਿੱਚ ਮੈਨੂੰ ਮਤਲਬ ਕਿ ਬਹੁਤ ਹੀ ਜ਼ਿਆਦਾ ਖੇਡਣਾ ਮੁਸ਼ਕਲ ਲੱਗਦਾ ਹੈ ਪਰ ਮੈਂ ਫਿਰ ਵੀ ਇਸਨੂੰ ਖੇਡ ਲੈਂਦੀ ਹਾਂ